ਸਿੱਖਿਆ ਰੁਜ਼ਗਾਰ ਅਤੇ ਸਮਾਜਿਕ ਸਥਿਤੀ ਦੇ ਰੂਪ ਵਿੱਚ ਰੂਪਨਗਰ ਜ਼ਿਲ੍ਹੇ ਵਿੱਚ ਔਰਤਾਂ ਨੂੰ ਸਿੱਖਿਆ ਦੇ ਮੁਕਾਬਲੇ ਅੱਛੀ ਸਮਾਨਤਾ ਨਹੀਂ ਦਿੱਤੀ ਜਾਂਦੀ ਹੈ ਰੁਜ਼ਗਾਰ ਦੇ ਮੌਕੇ ਵੀ ਔਰਤਾਂ ਨੂੰ ਨਹੀਂ ਦਿੱਤੇ ਜਾਂਦੇ ਹੈ ਅਤੇ ਸਮਾਜਿਕ ਸਥਿਤੀ ਦੇ ਰੂਪ ਵਿੱਚ ਵੀ ਔਰਤਾਂ ਨੂੰ ਮੁੰਡਿਆਂ ਦੇ ਬਰਾਬਰ ਮਰਦਾਂ ਦੇ ਬਰਾਬਰ ਘੱਟ ਘੱਟ ਸਮਾਨਤਾ ਦਿੱਤੀ ਜਾਂਦੀ ਹੈ